ਕਾਨੂੰਨੀ ਦਸਤਾਵੇਜ਼ ਬਣਾਉਣ ਲਈ ਸਾਨੂੰ ਜੇ ਅਸੀਂ ਕੋਰਟ ਤੋਂ ਕੋਈ ਕਾਗਜ਼ ਲੈਣੇ ਆ ਤਾਂ ਸਾਨੂੰ ਅਪਲਾਈ ਕੋਰਟ ਵ ਟਿਕਟਾਂ ਲਾ ਕੇ ਅਪਲਾਈ ਕਰਨਾ ਪੈਂਦਾ ਹੈ ਜੋ ਕਿ ਦਸਤਾਵੇਜ਼ ਪੰਜ ਛੇ ਦਿਨ ਵਿੱਚ ਮਿਲ ਜਾਂਦੇ ਹਨ ਅਤੇ ਜੇ ਉਹ ਕੋਈ ਸਰਕਾਰੀ ਮਹਿਕਮੇ ਦੇ ਦਸਤਾਵੇਜ਼ ਲੈਣੇ ਹੈ ਤਾਂ ਸਾਨੂੰ ਆਰ ਟੀ ਆਈ ਰਾਹੀਂ ਆਰ ਟੀ ਆਈ ਦੋ ਹਜ਼ਾਰ ਪੰਜ ਰੂਲ ਬਣਿਆ ਹੈ ਉਸ ਰਾਹੀਂ ਅਪਲਾਈ ਕਰਕੇ ਮਿਲ ਜਾਂਦੇ ਹਨ ਜੋ ਕਿ ਸਮਾਂ ਇੱਕ ਮਹੀਨੇ ਦਾ ਹੁੰਦਾ ਹੈ ਵੀ ਇੱਕ ਮਹੀਨੇ ਦੇ ਵਿੱਚ ਦੇਣੇ ਪੈਂਦੇ ਹਨ ਜੇਕਰ ਕੋਈ ਮਹਿਕਮਾ ਇੱਕ ਮਹੀਨੇ ਤੋਂ ਲੇਟ ਹੁੰਦਾ ਤਾਂ ਉਸਨੂੰ ਫ਼ਰੀ ਦੇਣੇ ਪੈਂਦੇ ਹਨ ਨਹੀਂ ਤਾਂ ਜੋ ਵੀ ਫ਼ੀਸ ਆ ਫੋਟੋਸਟੇਟ ਦੀ ਉਹ ਦੋ ਰੁਪਏ ਦੇ ਹਿਸਾਬ ਦੇ ਦਸਤਾਵੇਜ਼ ਦੇਣੇ ਪੈਂਦੇ ਹਨ ਜਮ੍ਹਾਂ ਕਰਵਾ ਕੇ ਅਤੇ ਬਾਕੀ ਦਸਤਾਵੇਜ਼ ਜਿਹੜੇ ਹੈਗੇ ਹੈ ਜਿਹੜੇ ਅਸੀਂ ਬਣਾਉਣੇ ਹੈ ਇਹ ਕੋਈ ਜਿਹੜਾ ਫਲਿਉਂਡ ਨਹੀਂ ਲੱਗਣਾ ਚਾਹੀਦਾ ਜਿੱਦਾਂ ਕੋਈ ਪੇਅਮੈਂਟ ਆ ਕੋਈ ਉਸਦੇ ਉ ਉਹਦੇ ਵਿੱਚ ਫਲਿਉਂਡ ਨਹੀਂ ਹੋਣਾ ਚਾਹੀਦਾ ਕੋਈ ਹੋਰ ਦਸਤਾਵੇਜ਼ ਬਣਾਉਣਾ ਉਹਦੇ ਮਾ ਕੋਈ ਫ਼ਲਿਉਡ ਕੱਟਿੰਗ ਨਹੀਂ ਹੋਣੀ ਚਾਹੀਦੀ ਕੋਈ ਖਾਲੀ ਕਾਗਜ਼ ਨਹੀਂ ਵਿੱਚ ਪੇਜ਼ ਛੱਡਣਾ ਚਾਹੀਦਾ ਅਤੇ ਬੜੇ ਧਿਆਨ ਗੈਲ ਇਹ ਜਿਹੜੇ ਦਸਤਾਵੇਜ਼ ਬਣਾਉਣੇ ਚਾਹੀਦੇ ਹਨ